ਮੈਂ ਪਿਛਲੇ ਸਾਲ ਹੀ ਸ਼ੂਟਿੰਗ ਸਟਾਰ ਦੇਖਿਆ ਸੀ ਮੈਂ ਅਤੇ ਮੇਰਾ ਭਰਾ ਰਾਤ ਨੂੰ ਤਾਰੇ ਦੇਖ ਰਹੇ ਸਨ ਅਤੇ ਉਦੋਂ ਅਸੀਂ ਦੋਹੇ ਅਸੀਂ ਦੋਨਾਂ ਨੇ ਸ਼ੂਟਿੰਗ ਸਟਾਰ ਦੇਖਿਆ ਸ਼ੂਟਿੰਗ ਸਟਾਰ ਦੇਖਦੇ ਹੀ ਅਸੀਂ ਆਪਣੇ ਆਪਣੀਆਂ ਅੱਖਾਂ ਬੰਦ ਕਰਕੇ ਇੱਕ ਇੱਕ ਵਿਸ਼ ਮੰਗੀ